ਹੈਲੋ ਐੱਸ ਐਮ ਰਿਜ਼ੋਟ ਤੋਂ ਬੋਲ ਰਹੇ ਹੋ ਮੈਂ ਤੁਹਾਨੂੰ ਪੰਜਾਹ ਬੰਦਿਆਂ ਦਾ ਖਾਣਾ ਮੰਗਵਾਇਆ ਸੀ ਸੈਨਪੁਰ ਪਤੇ 'ਤੇ ਹੁਣ ਮੈਂ ਐਡਰੈਸ ਚੇਂਜ ਕਰਨਾ ਚਾਹੁੰਦੀ ਹਾਂ ਦੂਸਰੇ ਉਹ ਦੂਸਰੇ ਚੇ ਦੂਸਰੇ ਔਡਰ ਉਹਦੇ ਪਰ ਮੰਗਵਾਉਣਾ ਚਾਹੁੰਦੀ ਹੈ ਐਡਰੈਸ 'ਤੇ ਪਿੰਡ ਨਾਨਕਪੁਰਾ ਧੰਨਵਾਦ